ਆਪਣਾ ਕਾਰੋਬਾਰ ਆਪਣਾ ਹੀ ਹੁੰਦਾ ਹੈ ਇਹ ਕਥਨ ਜਿੰਨਾ ਪੁਰਾਣਾ ਹੈ ਉੰਨਾ ਹੀ ਕਾਰੋਬਾਰ ਦੀਆਂ ਨਿਯਮਾਂ ਅਤੇ ਗਤੀਵਿਧੀਆਂ 'ਤੇ ਲਾਗੂ ਹੁੰਦਾ ਹੈ ਰਾਤੋ ਰਾਤ ਸਫਲਤਾ ਇੱਕ ਮਿੱਥ ਹੈ ਕਿਉਂਕਿ ਇਹ ਸੰਸਾਰ ਵਿੱਚ ਅਜਿਹੀ ਕੋਈ ਚੀਜ਼ ਮੌਜੂਦ ਨਹੀਂ ਹੈ ਰਾਤੋ ਰਾਤ ਸਫਲਤਾ ਸਮੇਂ ਦੇ ਨਾਲ ਸਥਿਰ ਅਤੇ ਨਿਰੰਤਰ ਛੋਟੇ ਯਤਨਾਂ ਦਾ ਸਿੱਟਾ ਹੈ ਇਸਦੇ ਲਗਾਤਾਰ ਵਾਧੇ ਦੇ ਕਾਰਨ ਬਹੁਤ ਸਾਰੇ ਉੱਦਮੀਆਂ ਨੇ ਵੱਡੀਆਂ ਅਦਾਇਗੀਆਂ ਹਿੱਟ ਹੋਣ ਤੋਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਹਰ ਨਵੇਂ ਕਾਰੋਬਾਰ ਲਈ ਨਕਦ ਪ੍ਰਵਾਹ ਦਾ ਪ੍ਰਬੰਧਨ ਕਰਨਾ ਜ਼ਰੂਰੀ ਹੈ ਅਤੇ ਜ਼ਿਆਦਾਤਰ ਉੱਦਮੀਆਂ ਨੂੰ ਆਪਣੇ ਕਾਰੋਬਾਰਾਂ ਦੇ ਨਕਦ ਪ੍ਰਵਾਹ ਦਾ ਪ੍ਰਬੰਧ ਕਰਨ ਵਿੱਚ ਮਦਦ ਦੀ ਲੋੜ ਹੁੰਦੀ ਹੈ ਸਹੀ ਸਮੱਸਿਆ ਜਾਂ ਉਸ ਦੀ ਪਰਖ 'ਚ ਦੇਰੀ ਨਾਲ ਪੈਦਾ ਹੋਈ ਦਿੱਕਤ ਇੱਕ ਉਦਯੋਗ ਨੂੰ ਸੰਸਾਰ ਵਿੱਚ ਖਤਮ ਕਰਨ ਦੇ ਕੰਢੇ ਲੈ ਆਉਂਦੀ ਹੈ ਮਾੜੀ ਨਕਦੀ ਪਰਵਾਹ ਯੋਜਨਾ ਦੇ ਕਾਰਨ ਕਰਮਚਾਰੀਆਂ ਨੂੰ ਦੇਰੀ ਨਾਲ ਭੁਗਤਾਨ ਕਰਨਾ ਅਤੇ ਸਟਾਫ ਦੇ ਮਨੋਬਲ ਅਤੇ ਤੁਹਾਡੀ ਕੰਪਨੀ ਵਿੱਚ ਉਹਨਾਂ ਦੇ ਵਿਸ਼ਵਾਸ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ ਇਸ ਲਈ ਪ੍ਰਾਪਤੀਆਂ ਅਤੇ ਅਦਾਇਗੀਆਂ ਨੂੰ ਚੈੱਕ ਵਿੱਚ ਰੱਖਣਾ ਤੁਹਾਡਾ ਫਰਜ਼ ਬਣ ਜਾਂਦਾ ਹੈ ਇਸ ਲਈ ਤੁਹਾਨੂੰ ਆਪਣੇ ਕਾਰੋਬਾਰ ਦੇ ਨਕਦ ਪਰਵਾਹ ਬਾਰੇ ਚਿੰਤਾ ਕਰਨ ਦੀ ਕੋਈ ਖ਼ਾਸ ਲੋੜ ਨਹੀਂ ਪਰ ਨਕਦ ਦਾ ਪ੍ਰਭਾਵ ਕਦੋਂ ਅਤੇ ਕਿਵੇਂ ਆਵੇਗਾ ਇਸ ਦਾ ਧਿਆਨ ਪੂਰਾ ਰੱਖਣਾ ਪੈਂਦਾ ਹੈ ਪ੍ਰਭਾਵਸ਼ਾਲੀ ਸਟਾਫ ਨੂੰ ਨਿਯੁਕਤ ਕਰਨਾ ਔਖਾ ਹੋ ਜਾਂਦਾ ਹੈ ਜਿਸ ਨਾਲ ਨਵੀਂ ਕੰਪਨੀ ਲਈ ਮਿਹਨਤੀ ਸਮਰਪਿਤ ਅਤੇ ਵਫ਼ਾਦਾਰ ਕਰਮਚਾਰੀਆਂ ਨੂੰ ਆਕਰਸ਼ਿਤ ਕਰਨਾ ਪੈਂਦਾ ਹੈ ਹਰ ਕਾਰੋਬਾਰ ਦੇ ਸ਼ੁਰੂਆਤੀ ਪੜਾਅ 'ਤੇ ਇੱਕ ਵਪਾਰੀ ਆਪਣੇ ਕਰਮਚਾਰੀਆਂ ਨੂੰ ਚੰਗੀਆਂ ਕੰਪਨੀਆਂ ਨਾਲੋਂ ਵੈਦਰ ਸਥਿਤੀਆਂ ਪ੍ਰਦਾਨ ਕਰਨ ਵਿੱਚ ਕਈ ਵਾਰ ਸਹਾਇਕ ਹੁੰਦੇ ਹਨ ਜਾਂ ਕਈ ਵਾਰ ਸਹਾਇਕ ਨਾ ਹੋਣ ਦੇ ਕਾਰਨ ਉਹ ਜਿਹੇ ਕਰਮਚਾਰੀਆਂ ਨੂੰ ਗੁਆ ਬੈਠਦੇ ਹਨ ਨਾਲ ਹੀ ਪ੍ਰਤੀਭਾਸ਼ਾਲੀ ਕਰਮਚਾਰੀਆਂ ਚਾਰੀਆਂ ਦੀ ਭਰਤੀ ਕਰਨਾ ਇੱਕ ਸਮਾਂ ਬਰਦਾਸ਼ਤ ਪ੍ਰਕਿਰਿਆ ਹੈ ਇਸ ਲਈ ਨੌਕਰੀ ਦੀ ਭੂਮਿਕਾ ਲਈ ਖ਼ਾਸ ਵਰਨਣ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ ਸਮਾਂ ਪ੍ਰਬੰਧਨ ਇੱਕ ਮਹੱਤਵਪੂਰਨ ਕਾਰਜ ਹੈ ਜਿਸਦਾ ਅਭਿਆਸ ਹਰ ਕਰਮਚਾਰੀ ਅਤੇ ਉਦਯੋਗਪਤੀ ਨੂੰ ਕਰਨਾ ਚਾਹੀਦਾ ਹੈ ਹਾਲਾਂਕਿ ਇਹ ਹਰੇਕ ਉਦਯੋਗਪਤੀ ਦੁਆਰਾ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਇਹ ਇਸ ਲਈ ਹੈ ਕਿਉਂਕਿ ਉਹ ਹਮੇਸ਼ਾ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਵਧੇਰੇ ਸਮਾਂ ਚਾਹੁੰਦੇ ਹਨ ਇਸ ਲਈ ਤੁਹਾਨੂੰ ਇੱਕ ਟੀਚਾ ਸੂਚੀ ਬਣਾ ਕੇ ਰੋਜ਼ਾਨਾ ਕੰਮਾਂ ਨੂੰ ਜੋੜ ਕੇ ਆਪਣੇ ਕੰਮ ਨੂੰ ਇੱਕ ਸਾਰ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਰੇ ਕੰਮ ਪੂਰੇ ਅਤੇ ਯਕੀਨੀ ਹੋ ਸਕਦੇ ਹਨ ਹਰੇਕ ਉਦਯੋਗਪਤੀ ਨੂੰ ਪੂੰਜੀ ਲਈ ਕ੍ਰੈਡਿਟ ਦੀ ਇੱਕ ਲਾਈਨ ਜਾਂ ਇੱਕ ਛੋਟੇ ਕਾਰੋਬਾਰੀ ਕਰਜ਼ੇ ਦੀ ਲੋੜ ਹੁੰਦੀ ਹੈ ਅਜਿਹੇ ਵਿੱਚ ਲਾਗਤ ਵਿੱਚ ਕਟੌਤੀ ਇੱਕ ਲਾਭਕਾਰੀ ਵੀ ਵਿਕਲਪ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਹਾਲਾਂਕਿ ਜੇਕਰ ਤੁਸੀਂ ਹਾਲ ਹੀ ਵਿੱਚ ਗ੍ਰੈਜੂਏਟ ਹੋ ਤਾਂ ਫੰਡ ਇਕੱਠਾ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ ਕਿਉਂਕਿ ਨਵੇਂ ਉੱਦਮੀ ਲਈ ਕ੍ਰੈਡਿਟ ਪ੍ਰਾਪਤ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਵੱਡੀਆਂ ਕੰਪਨੀਆਂ ਵਿੱਚ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚ ਖ਼ਾਸ ਤੌਰ 'ਤੇ ਖ਼ਾਸ ਹੁਨਰਾਂ ਜਾਂ ਗਿਆਨ ਖੇਤਰਾਂ ਲਈ ਅੰਦਰੂਨੀ ਮਾਪਦੰਡ ਸਥਾਪਤ ਕਰਨਾ ਫਿਰ ਸਿਖਲਾਈ ਮੁਲਾਂਕਣਾ ਦਾ ਧਿਆਨ ਕਰਨਾ ਅਤੇ ਕਈ ਵਾਰ ਵਿਹਾਰਕ ਪ੍ਰਦਰਸ਼ਨਾਂ ਦੁਆਰਾ ਕਰਮਚਾਰੀਆਂ ਦਾ ਉਹਨਾਂ ਮਾਪ ਦੰਡਾਂ ਦੇ ਵਿਰੁੱਧ ਮੁਲਾਂਕਣ ਕਰਨਾ ਅੰਤ ਵਿੱਚ ਉਹਨਾਂ ਨੂੰ ਇੱਕ ਮਾਨਤਾ ਪ੍ਰਾਪਤ ਸਰਟੀਫਿਕੇਟ ਪ੍ਰਦਾਨ ਕਰਨਾ ਸਰਟੀਫਿਕੇਸਨ ਦਾ ਸਾਰਾ ਪ੍ਰੋਸੈਸ ਵਿੱਚ ਸ਼ਾਮਲ ਹੁੰਦਾ ਹੈ ਜੋ ਸਫਲਤਾ ਪੂਰਵਕ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਅਕਸਰ ਸੰਗਠਨ ਦੇ ਅੰਦਰ ਕਰਮਚਾਰੀਆਂ ਦੀ ਯੋਗਤਾ ਅਤੇ ਕਰੀਅਰ ਦੀ ਤਰੱਕੀ ਨੂੰ ਪ੍ਰਮਾਣਿਤ ਕਰਨ ਲਈ ਸਰਟੀਫਿਕੇਸ਼ਨ ਦਾ ਪ੍ਰੋਸੈਸ ਕੀਤਾ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਕਾਰੋਬਾਰ ਵਿੱਚ ਹਿੱਸੇਦਾਰੀ ਬਾਰੇ ਸੋਚ ਸਕਦੇ ਹੋ ਵਧੇਰੇ ਮਾਲਕਾਂ ਦੇ ਨਾਲ ਕੰਪਨੀ ਦੀ ਵਿੱਤ ਨੂੰ ਇਕੱਠਾ ਕਰਨਾ ਆਸਾਨ ਹੋ ਸਕਦਾ ਹੈ ਧੰਨਵਾਦ